ਸਵਰਗਵਾਸੀ ਸਰਦਾਰ ਕੁਲਵੰਤ ਸਿੰਘ ਸੈਣੀ ਸਰਦਾਰਨੀ ਕਮਲਜੀਤ ਕੌਰ ਸੈਣੀ ਸਰਦਾਰ ਗਗਨਪ੍ਰੀਤ ਸਿੰਘ ਸੈਣੀ ਸਰਦਾਰ ਅਮਨਪ੍ਰੀਤ ਸਿੰਘ ਸੈਣੀ ਸਰਦਾਰ ਸੁਖਚੈਨ ਸਿੰਘ ਸੈਣੀ